ਹੈਲੋ

ਹਾਂਜੀ ਹਾਂਜੀ ਬੱਚੇ ਮੈਂ ਨਾ ਸਾਡਾ ਜਿਹੜਾ ਪਿੰਡ ਪਵਾਵੰਡੀ ਇਹਨੂੰ ਨਾ ਜਿਹੜੇ ਤਿੰਨ ਸਕੂਲ ਬੈਸਟ ਮੈਂ ਚੂਜ ਕੀਤੇ ਸੀਗੇ ਇਹ ਜਿਹੜੇ ਕੋਲ ਕੋਲ ਨੇ ਇੱਕ ਤਾਂ ਦੇਖੋ ਜੇ ਤਾਂ ਮੈਂ ਬਰਨਾਲੇ ਵਾਲੀ ਸਾਈਡ ਜਾਵਾਂ ਤਾਂ ਮਦਰ ਟੀਚਰ ਅਤੇ ਵਾਈ ਐਸ ਸਕੂਲ ਠੀਕ ਹੈ ਜੀ ਅਤੇ ਜੇ ਮੈਂ ਬਠਿੰਡੇ ਸਾਈਡ ਰੰਪੇ ਸਾਈਡ ਜਾਵਾਂ ਤਾਂ ਦੂਣ ਸਕੂਲ ਮਤਲਬ ਤਪੇ ਤੋਂ ਥੋੜ੍ਹਾ ਬਾਰ੍ਹਾਂ ਕਿਲੋਮੀਟਰ ਆ ਦੂਰ ਆ ਅਤੇ ਇਹਨਾਂ ਤਿੰਨਾਂ ਦੀ ਇਹਨਾਂ ਤਿੰਨਾਂ 'ਚ ਮੈਂ ਦੋ ਸਕੂਲ ਬੈਸਟ ਕੀਤੇ ਫਸਟ 'ਤੇ ਦੂਨ ਸਕੂਲਮ ਅਤੇ ਸੈਕਿੰਡ 'ਤੇ ਮਦਰ ਟੀਚਰ ਹਾਂਜੀ ਅਤੇ ਇਹਨਾਂ ਦੀ ਜਿਹੜੀ ਮਤਲਬ ਕੁਆਲਿਟੀ ਔਫ ਐਜੂਕੇਸ਼ਨ ਉਹ ਵੀ ਵਧੀਆ ਗੀ ਬੱਚਿਆਂ ਦੇ ਕੋਈ ਫਾਲਤੂ ਬੋਝ ਨਹੀਂ ਹੁੰਦਾ ਗਾ ਫਾਲਤੂ 'ਤੇ ਕੋਈ ਐਕਟੀਵਿਟੀਜ਼ 'ਤੇ ਬਾਕੀ ਇਹਦੇ ਨਾਲ ਨਾਲ ਜਿਹੜੇ ਸਪੋਰਟ ਐਕਟੀਵਿਟੀ ਨੇ ਉਹ ਵੀ ਵਧੀਆ ਨੇ ਜਿਵੇਂ ਹੁਣ ਆਪਾਂ ਮਦਰ ਟੀਚਰ ਸਕੂਲ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇੱਕ ਇੰਨਡੋਰ ਸਵੀਮਿੰਗ ਪੂਲ ਬੈਡਮਿੰਟਨ ਕੋਟ ਬਣਿਆ ਹੋਇਆ ਇਹਦਾ ਬਾਸਕਿਟਬੋਲ ਕੋਟ ਬਣਿਆ ਹੋਇਆ ਗਾ ਇਹ ਮੈਂ ਦੇਖ ਕੇ ਆਇਆ ਖੁਦ ਉੱਥੇ ਅਤੇ ਵਧੀਆ ਚੀਜ਼ ਆ ਇਹ ਅਤੇ ਬਾਕੀ ਦੂਨ ਪਬਲਿਕ ਸਕੂਲ ਦੀ ਗੱਲ ਕਰੀਏ ਤਾਂ ਉੱਥੇ ਕੁਆਲਿਟੀ ਆਫ ਐਜੂਕੇਸ਼ਨ ਬਹੁਤ ਜ਼ਿਆਦਾ ਵਧੀਆ ਗੀ ਕਿਉਂਕਿ ਸਾਡੇ ਗੁਆਂਢੀਆਂ ਦੇ ਬੱਚੇ ਇੱਥੇ ਪੜਦੇ ਸੀ ਮੈ ਇਕ ਦੋ ਵਾਰ ਵਿਜਿਟ ਕੀਤਾ ਬਹੁਤ ਸੋਹਣਾ ਸਕੂਲ ਆ ਅਤੇ ਮਤਲਬ ਬਹੁਤ ਵਧੀਆ ਉੱਥੇ ਸਟੱਡੀ ਆ ਪ੍ਰਿੰਸੀਪਲ ਚੇਅਰਮੈਨ ਅਤੇ ਸਾਰਾ ਸਟਾਫ ਬਹੁਤ ਵਧੀਆ ਕਿਉਂਕਿ ਤੁਸੀਂ ਦੇਖੋ

ਨਹੀਂ ਰੈਗੂਲਰ ਤਾਂ ਨਹੀਂ ਹੁੰਦੀ ਦੇਖੋ ਤਿੰਨ ਮਹੀਨੇ ਬਾਅਦ ਹੁੰਦੀ ਉਹਨਾਂ ਦੀ ਜੇ ਤੁਸੀਂ ਫਿਜੀਕਲੀ ਜਾਣਾ ਗਾ ਤਾਂ ਉਹਦਾ ਵੀ ਮਤਲਬ ਉਥੇ ਹੁੰਦਾ ਗਾ ਜੇ ਤੁਸੀਂ ਨਹੀਂ ਜਾ ਸਕਦੇ ਜੇ ਤੁਸੀਂ ਆਨਲਾਈਨ ਵਰਚੁਅਲ ਕਰਨੀ ਹੈ ਤੁਸੀਂ ਤਾਂ ਉਹਨੂੰ ਲਿੰਕ ਸੈਂਡ ਕਰਦੇ ਤਾਂ ਤੁਸੀਂ ਉਥੋਂ ਉਹ ਵੀ ਤੁਸੀਂ ਅਟੈਂਡ ਕਰ ਸਕਦੇ ਹੋ ਦੂਣ ਦੇ ਵਿੱਚ ਹਾਂ ਹਾਂ ਨਹੀਂ ਦੇਖੋ ਫੀਸ ਬਾਰੇ ਮੈਂ ਹਜੇ ਕੋਈ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿਉਂਕਿ ਮੈਂ ਸਿਰਫ਼ ਦੇਖੇ ਸੀਗੇ ਸਕੂਲ ਠੀਕ ਹੈ ਜੀ ਹਾਂ ਅਤੇ ਕਿਉਂਕਿ ਹੁਣ ਨਵੇਂ ਸੈਸ਼ਨ ਦੇ ਵਿੱਚ ਬੱਚਿਆਂ ਦੀ ਜਦੋਂ ਐਡਮਿਸ਼ਨਾ ਹੋਣਗੀਆਂ ਫਿਰ ਮੈਂ ਸਾਰਾ ਜਿਹੜਾ ਫੀਸ ਸਟਰਕਚਰ ਆ ਉਹ ਇਹਨਾਂ ਦਾ ਮੈਂ ਕਰੂੰਗਾ ਪਤਾ ਅਤੇ ਬਾਕੀ ਹੈ ਵੀ ਜੇ ਇੱਕ ਹੋਰ ਸਕੂਲ ਆ ਉਹ ਥੋੜ੍ਹਾ ਕੋਸਟਲੀ ਜਿਵੇਂ ਸੈਂਟਿਕ ਸੈਂਟੀਵੀਅਰ ਹੋ ਗਿਆ ਬਰਨਾਲਾ ਅਤੇ ਪਰੰਪਰਾ ਹਾਂ ਹਾਂ ਇਹਨਾਂ ਵਿੱਚ ਫਿਰ ਅਜੇ ਥੋੜ੍ਹਾ ਜਿਹਾ ਆਹ ਕੰਪਟੀਸ਼ਨ ਜ਼ਿਆਦਾ ਹੋ ਜਾਂਦਾ ਬੱਚਿਆਂ ਦਾ ਤੋ ਜਿਆਦਾ ਬੋਝ ਪਾਉਣ ਦੀ ਕੋਈ ਆਈਡੀਆ ਹੈ ਨਹੀਂ ਗਾ ਬੱਚਿਆਂ 'ਤੇ ਹਾਂਜੀ ਹਾਂ ਹਾਂ ਬਾਕੀ ਤੂ ਹਾਂਜੀ ਹਾਂ ਬਿਲਕੁਲ ਹਾਂ ਦੋਵਾਂ ਦੋਵਾਂ ਸਕੂਲਾਂ ਵਿੱਚ ਹੀ ਕਿਉਂਕਿ ਜੇ ਦੋ ਸਕੂਲ ਦੀ ਗੱਲ ਕਰੀਏ ਇਹਨਾਂ ਦੀ ਆਪਣੀ ਹਾਕੀ ਦੀ ਟੀਮ ਆ ਫੁਟਬਾਲ ਦੀ ਟੀਮ ਵੀ ਹੈਗੀ ਇਹਨਾਂ ਦੀ ਹਾਂਜੀ ਹਾਂ ਬਾਕੀ ਇਹਨਾਂ ਕੋਲ ਗਰਾਊਂਡ ਵੀ ਆਪਣੇ ਆ ਤਾਂ ਇਹ ਚੀਜ਼ ਮੈਨੂੰ ਵਧੀਆ ਲੱਗੀ ਇਹਨਾਂ ਦੀ ਬਾਕੀ ਹੋਰ ਕਲਚਰਲ ਐਕਟੀਵਿਟੀਆਂ ਵੀ ਬਹੁਤ ਕਰਦੇ ਨੇ ਇਹ ਹਾਂਜੀ ਬਾਕੀ ਤੁਸੀਂ ਹਾਂ ਬਾਕੀ ਤੁਸੀਂ ਦੇਖ ਲਿਓ ਬਸ ਜਿਹੜਾ ਠੀਕ ਲੱਗਿਆ ਤੁਹਾਨੂੰ ਹਾਂ ਠੀਕ ਹੈ ਓਕੇ ਜੀ